ਮੈਂ ਡਿਜੀਟਲ ਭੁਗਤਾਨ ਐਪਸ ਵਿੱਚੋਂ ਫ਼ੋਨਪੇ ਦੀ ਵਰਤੋਂ ਕਰਦੀ ਹਾਂ ਇਹ ਇੱਕ ਮੋਬਾਈਲ ਐਪਲੀਕੇਸ਼ਨ ਹੈ ਜਿਸ ਰਾਹੀਂ ਅਸੀਂ ਆਪਣੀ ਪੇਮੈਂਟਸ ਕਰ ਸਕਦੇ ਹਾਂ ਫ਼ੋਨਪੇ ਰਾਹੀਂ ਭੁਗਤਾਨ ਕਰਕੇ ਬਹੁਤ ਹੀ ਲਾਭ ਹੁੰਦੇ ਹਨ ਜਿਵੇਂ ਕਿ ਅਸੀਂ ਆਪਣੇ ਪੈਸਿਆਂ ਨੂੰ ਕੈਸ਼ਲੈੱਸ ਤਰੀਕੇ ਨਾਲ ਸਿੱਧੇ ਆਪਣੇ ਬੈਂਕ ਅਕਾਊਂਟ ਵਿੱਚ ਟ੍ਰਾਂਸਫਰ ਕਰ ਸਕਦੇ ਹਾਂ ਇਸ ਨਾਲ ਅਸੀਂ ਆਪਣੀ ਡਿਜੀਟਲ ਪੇਮੈਂਟਸ ਨੂੰ ਘਰ ਬੈਠਿਆਂ ਹੀ ਕਰ ਸਕਦੇ ਆਂ ਅਸੀਂ ਜੇਕਰ ਬਿੱਲ ਅਤੇ ਪੈਸੇ ਸੈਂਡ ਕਰਨੇ ਹੋਣ ਤਾਂ ਇਹ ਉਹ ਵੀ ਸੁਖਾਲੇ ਤਰੀਕੇ ਨਾਲ ਹੋ ਸਕਦਾ ਹਾਂ ਸਾਨੂੰ ਬੈਂਕ ਵਿੱਚ ਜਾਣ ਦੀ ਲੋੜ ਵੀ ਨਹੀਂ ਪੈਂਦੀ ਅਸੀਂ ਆਪਣੇ ਗੈਸ ਸਿਲੰਡਰ ਬਿਜਲੀ ਦੇ ਬਿਲ ਨੂੰ ਘਰ ਬੈਠੇ ਹੀ ਭੁਗਤਾਨ ਕਰ ਸਕਦੇ ਹਾਂ ਜੇਕਰ ਅਸੀਂ ਰੀਚਾਰਜ ਵੀ ਕਰਨਾ ਹੋਵੇ ਤਾਂ ਉਹ ਵੀ ਬੜੀ ਆਸਾਨੀ ਨਾਲ ਘਰ ਬੈਠ ਕੇ ਹੀ ਹੋ ਜਾਂਦਾ ਸਾਨੂੰ ਦੁਕਾਨ 'ਤੇ ਜਾ ਕੇ ਕਰਾਉਣ ਦੀ ਜ਼ਰੂਰਤ ਵੀ ਨਹੀਂ ਪੈਂਦੀ ਇਹ ਉਹ ਅ ਐਪਲੀ ਮੋਬਾਈਲ ਐਪਲੀਕੇਸ਼ਨ ਬਹੁਤ ਹੀ ਲਾਭਦਾਇਕ ਹੁੰਦੀ ਹੈ ਅਸੀਂ ਔਨਲਾਈਨ ਐਪਸ 'ਤੇ ਸ਼ੋਪਿੰਗ ਕਰਕੇ ਫ਼ੋਨਪੇ ਨੂੰ ਯੂਜ ਕਰਦੇ ਹੋਏ ਡਿਸਕਾਊਂਟ ਵੀ ਪ੍ਰਾਪਤ ਕਰ ਸਕਦੇ ਹਾਂ ਕਈ ਵਾਰ ਅਸੀਂ ਇਸ ਦੇ ਨੁਕਸਾਨ ਵੀ ਦੇਖ ਸਕਦੇ ਹਾਂ ਜਿਵੇਂ ਕਿ ਅਸੀਂ ਪੇਮੈਂਟਸ ਕਰ ਦਿੱਤੀ ਹੋਵੇ ਪਰ ਅਗਲੇ ਬੰਦੇ ਤੱਕ ਨਾ ਪੁੱਜੀ ਅਤੇ ਪੇਮੈਂਟ ਦਾ ਪ੍ਰੋਸੈਸ ਰੁੱਕ ਜਾਂਦਾ ਹੈ ਹੋਰ ਵੀ ਬੈਂਕ ਦੀਆਂ ਰੁਕਾਵਟਾਂ ਆ ਜਾਂਦੀਆਂ ਹਨ ਇਸ ਕਰਕੇ ਫ਼ੋਨਪੇ ਨੂੰ ਧਿਆਨ ਨਾਲ ਵਰਤਦੇ ਹੋਏ ਅਸੀਂ ਇਸ ਦੀਆਂ ਸੁਵਿਧਾਵਾਂ ਲੈ ਸਕਦੇ ਹਾਂ